ਰੰਗਾਂ ਨੂੰ ਰੰਗਣ ਲਈ ਕਈ ਤਰ੍ਹਾਂ ਦੇ ਮੀਡੀਅਮਸ ਮਾਧਿਅਮ ਮੀਡੀਅਮਸ ਜਾਂ ਮਾਧਿਅਮ ਦੀ ਵਰਤੋਂ ਕੀਤੀ ਜਾਂ ਕੀਤੀ ਜਾਂਦੀ ਹੈ ਅਲੱਗ ਅਲੱਗ ਲੋਕ ਅਲੱਗ ਅਲੱਗ ਤਰ੍ਹਾਂ ਦੇ ਮਾਧਿਅਮ ਦੀ ਵਰਤੋਂ ਕਰਦੇ ਹਨ ਰੰਗਣ ਲਈ ਜਿਵੇਂ ਮੈਨੂੰ ਪੇਂਟਿੰਗ ਵਿੱਚ ਮੀਡੀਅਮ ਅਲੱਗ ਅਲੱਗ ਤਰ੍ਹਾਂ ਦੇ ਮੀਡੀਅਮ ਜਿਵੇਂ ਆਟੀਕਲਸ ਹੋ ਗਿਆ ਵੋਟਰ ਕਲਰ ਹੋ ਗਿਆ ਫਿਕਸਰ ਹੋ ਗਿਆ ਬਾਈਂਡਰ ਹੋ ਗਿਆ ਇੰਕ ਹੋ ਗਿਆ ਓਇਲ ਹੋ ਗਿਆ ਮੈਂ ਇਨ੍ਹਾਂ ਸਭ ਇੰਨਗ੍ਰੀਅਨਸ ਜਾਂ ਮਾਧਿਅ ਜਾਂ ਮੀਡੀਅਮਸ ਜਾਂ ਮਾਧਿਅਮ ਦੀ ਵਰਤੋਂ ਕਰਦੀ ਹਾਂ ਇਸ ਨਾਲ ਇਸ ਨਾਲ ਇਸ ਦੀ ਵਰਤੋਂ ਨਾਲ ਜ ਜੇ ਆਪਾਂ ਜਿਹੜੇ ਆਪਾਂ ਫੈਬਰਿਕ ਉੱਤੇ ਕਲਰ ਕੀਤਾ ਹੁੰਦਾ ਹੈ ਉਸਨੂੰ ਧੋਣ ਤੋਂ ਬਾਅਦ ਜਿਹੜਾ ਉਹ ਕਲਰ ਹੈ ਉਹ ਉੱਤਰਦਾ ਨਹੀਂ ਗਾ ਅਤੇ ਉਹ ਫਿਕਸ ਹੋ ਜਾਂਦਾ ਆ ਅਤੇ ਉਹ ਧੋਣ ਤੋਂ ਬਾਅਦ ਨਾ ਕੱਪੜਾ ਸੁੰਗੜਦਾ ਆ ਅਤੇ ਨਾ ਪੂਰੇ ਕੱਪੜੇ ਵਿੱਚ ਜਿਹੜਾ ਕਲਰ ਆ ਉਹ ਆਪਣਾ ਜਿਹੜਾ ਕਲਰ ਉਹ ਫੈਲਦਾ ਨਹੀਂ ਗਾ ਇਸ ਲਈ ਮੈਂ ਇਹਨਾਂ ਸਭ ਜਿਹੜੇ ਫਿਕਸ ਜਾਂ ਮਾਧਿਅਮ ਨੇ ਇਹਨਾਂ ਦੀ ਵਰਤੋਂ ਕਰਨੀ ਵਧੀਆ ਸਮਝਦੀ ਹਾਂ ਅਤੇ ਇਹਦੇ ਨਾਲ ਜਿਹੜੀ ਫਿਨਿਸ਼ਿੰਗ ਆ ਉਹ ਵਧੀਆ ਆਉਂਦੀ ਆ ਠੀਕ ਹੈ ਇਸ ਨੂੰ ਆਪਣੇ ਪੇਂਟਿੰਗ ਵਿੱਚ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਵੱਡੇ ਵੱਡੇ ਜਿਹੜੇ ਪੇਂਟਿੰਗ ਕਰਦੇ ਆ ਪੇਂਟਿੰਗ ਯੂਜ ਕਰਦੇ ਆ ਉਹ ਲੋਕਰ ਫਿਕਸਰ ਬਾਈਂਡਰ ਆਦਿ ਦੀ ਵਰਤੋਂ ਕਰਦੇ ਹਨ ਕਲਰ ਨੂੰ ਮਿਕਸ ਕਲਰ ਨੂੰ ਮਿਕਸ ਕਰਨ ਮਿਕਸ ਕਰਨ ਕਲਰ ਕਈ ਕਲਰ ਨੂੰ ਮਿਕਸ ਕ ਜਿਵੇਂ ਮਿਕਸ ਕੀਤਾ ਜਾਂਦਾ ਹੈ ਜਿਵੇਂ ਰੈੱਡ ਅਤੇ ਬਲਿਊ ਨੂੰ ਮਿਕਸ ਕਰਕੇ ਪਰਪਲ ਬਣਦਾ ਹੈ ਅਤੇ ਬਲਿਊ ਅਤੇ ਬਲਿਊ ਅਤੇ ਲ ਬਲਿਊ ਬਲਿਊ ਅਤੇ ਔਰੇਂਜ ਨੂੰ ਮਿਕਸ ਕਰਕੇ ਗ੍ਰੀਨ ਕਲਰ ਬਣਦਾ ਹੈ ਵਾਈਟ ਅਤੇ ਰੈੱਡ ਨੂੰ ਮਿਕਸ ਕਰਕੇ ਪਿੰਕ ਕਲਰ ਬਣਦਾ ਹੈ ਅਤੇ ਬਲਿਊ ਅਤੇ ਵਾਈਟ ਨੂੰ ਮਿਕਸ ਕਰਕੇ ਬਲੈਕ ਅਤੇ ਵਾਈਟ ਨੂੰ ਮਿਕਸ ਕਰਕੇ ਗਰੇਅ ਕਲਰ ਬਣਦਾ ਹੈ ਇਸ ਇਸ ਨਾਲ ਸਕੈਂਡਰੀ ਪ੍ਰਾਈਮਰੀ ਟਰਸ਼ਰੀ ਕਲਰ ਆਦਿ ਬਣਦੇ ਹਨ